ਕਬੱਡੀ ਖੇਡ ਔਲ ਵਰਲਡ ਦੇ ਵਿੱਚ ਬਹੁਤ ਮਸ਼ਹੂਰ ਹੈ ਪੰਜਾਬ ਵਿੱਚ ਤਾਂ ਕਬੱਡੀ ਦੀ ਖੇਡ ਖੇਡੀ ਹੀ ਜਾਂਦੀ ਹੈ ਇਹ ਖੇਡ ਨੂੰ ਖੇਡਣ ਲਈ ਸਾਰੇ ਚਾਹਵਾਨ ਹਨ ਕਬੱਡੀ ਸਾਡੇ ਪੰਜਾਬ ਦੀ ਸ਼ਾਨ ਹੈ ਹਰੇਕ ਟੀਮ ਵਿੱਚ ਮੈਦਾਨ ਵਿੱਚ ਸੱਤ ਖਿਡਾਰੀ ਹੁੰਦੇ ਹਨ ਪੰਜ ਸਪੇਅਰ ਰੱਖੇ ਜਾਂਦੇ ਹਨ ਗੇਮ ਵਿੱਚ ਦੋ ਅੱਧ ਹੁੰਦੇ ਹਨ ਹਰ ਇੱਕ ਵੀਹ ਮਿੰਟ ਤੱਕ ਚੱਲਦਾ ਹੈ ਵਿਚਕਾਰ ਵਿੱਚ ਪੰਜ ਮਿੰਟ ਦੀ ਬਰੇਕ ਦਿੱਤੀ ਜਾਂਦੀ ਹੈ ਕਬੱਡੀ ਖੇਡਣ ਤੋਂ ਪਹਿਲਾਂ ਅਸੀਂ ਆਪਣੇ ਸਰੀਰ ਨੂੰ ਗਰਮ ਕਰਦੇ ਹਾਂ ਵਾਰਮ ਅੱਪ ਕਰਦੇ ਹਾਂ ਇਹ ਅਸੀਂ ਇਸ ਕਰਕੇ ਕਰਦੇ ਹਾਂ ਕਿਉਂਕਿ ਇਹਦੇ ਨਾਲ਼ ਸਾਡੀ ਖੇਡ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਜਾ ਸਕੇ ਕਬੱਡੀ ਖੇਡ ਅਸੀਂ ਸਾਰੇ ਇੱਕਜੁੱਟ ਹੋ ਕੇ ਖੇਡਦੇ ਹਾਂ ਸਾਨੂੰ ਕਬੱਡੀ ਤੇ ਰੱਬ ਵਰਗਾ ਮਾਣ ਹੈ ਸਾਡੇ ਪਿੰਡ ਸ਼ਹਿਰ ਵਿੱਚ ਇੱਕ ਮੇਲਾ ਲੱਗਦਾ ਹੈ ਜੋ ਸਾਡੇ ਮੇਲੇ ਵਿੱਚ ਕਲੱਬਾਂ ਵਾਲੇ ਕਬੱਡੀ ਟੂਰਨਾਮੈਂਟ ਕਰਵਾਉਂਦੇ ਹਨ ਅਸੀਂ ਸਾਰੇ ਜ਼ਿਲ੍ਹੇ ਸਾਡੀ ਸਾਰੀ ਟੀਮ ਵੱਧ ਚੜ੍ਹ ਕੇ ਹਿੱਸਾ ਲੈਂਦੀ ਹੈ ਇਸ ਵਿੱਚ ਬਹੁਤ ਜ਼ੋਰ ਲੱਗਦਾ ਹੈ ਅਸੀਂ ਪੰਜਾਬ ਦੇ ਹੋਣ ਕਰਕੇ ਦੇਸੀ ਘੀ ਅਤੇ ਮੱਖਣ ਦੇ ਪਲੇ ਹੋਏ ਹਾਂ ਸਾਡਾ ਸਰੀਰ ਸਾਡਾ ਪਿੰਡਾ ਜਿਸ ਦੇ ਉੱਪਰ ਕੀ ਮੱਖੀ ਤਿਲਕਦੀ ਹੈ ਐਡਾ ਸਰੀਰ ਅਸੀਂ ਮਤਲਬ ਕਬੱਡੀ ਲਈ ਏਨਾ ਅਸੀਂ ਸਰੀਰ ਮਤਲਬ ਤਿਆਰ ਕੀਤਾ ਹੋਇਆ ਹੈ ਇਸ ਲਈ ਫਿਰ ਅਸੀਂ ਟੂਰਨਾਮੈਂਟਾਂ ਵਿੱਚ ਖੇਡਦੇ ਹਾਂ ਸਾਨੂੰ ਆਪਣੇ ਆਪ ਤੇ ਮਾਣ ਹੁੰਦਾ ਹੈ ਕਬੱਡੀ ਨਾਲ਼ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਸਾਡੇ ਸਰੀਰ ਦੀ ਐਕਸਰਸਾਈਜ਼ ਹੁੰਦੀ ਹੈ ਕਬੱਡੀ ਨਾਲ਼ ਕਬੱਡੀ ਔਲ ਵਰਲਡ ਵਿੱਚ ਖੇਡੀ ਜਾਂਦੀ ਹੈ ਕਬੱਡੀ ਸਾਡੇ ਰੂਹ ਦੀ ਖ਼ੁਰਾਕ ਹੈ ਕਬੱਡੀ ਨਾਲ਼ ਜ਼ੋਰ ਅਜਮਾਇਆ ਜਾਂਦਾ ਹੈ ਕਬੱਡੀ ਨਾਲ਼ ਦੇਸ਼ ਵਿਦੇਸ਼ ਵਿੱਚ ਸਾਡੇ ਰਿਲੇਸ਼ਨ ਵਧੀਆ ਬਣਦੇ ਹਨ ਅਸੀਂ ਇੱਕ ਦੂਜੇ ਨਾਲ਼ ਪਿਆਰ ਭਾਵਨਾ ਨਾਲ਼ ਰਹਿੰਦੇ ਹਾਂ ਅਸੀਂ ਕਬੱਡੀ ਤੋਂ ਲੜਨਾ ਅਤੇ ਨਸ਼ੇ ਕਰਨ ਤੋਂ ਰਹਿਤ ਰਹਿੰਦੇ ਹਾਂ ਜਦੋਂ ਕਿ ਅਸੀਂ ਕਬੱਡੀ ਕੋਈ ਵੀ ਗੇਮ ਅਸੀਂ ਖੇਡਦੇ ਹਾਂ ਜਿਵੇਂ ਕਿ ਅਸੀਂ ਕਬੱਡੀ ਖ਼ਾਸਕਰ ਮੈਂ ਕਬੱਡੀ ਬਾਰੇ ਤੁਹਾਨੂੰ ਦੱਸ ਰਿਹਾਂ ਜਦੋਂ ਅਸੀਂ ਇਹ ਗੇਮਾਂ ਨੂੰ ਕੋਈ ਵੀ ਗੇਮ ਕਿਸੇ ਦੀ ਕਬੱਡੀ ਖੇਡਦੇ ਹਾਂ ਤਾਂ ਅਸੀਂ ਜਿਹੜੇ ਮਤਲਬ ਲੋਕਾਂ ਦੀਆਂ ਚੁਗ਼ਲੀਆਂ ਤੇ ਲੋਕਾਂ ਦੇ ਮਤਲਬ ਲੜਾਈ ਝਗੜੇ ਤੋਂ ਅਤੇ ਸ਼ਰਾਬ ਦਾਰੂ ਕਿਸੇ ਕਿਸਮ ਦੇ ਨਸ਼ੇ ਤੋਂ ਰਹਿਤ ਰਹਿੰਦੇ ਹਾਂ ਸਰੀਰ ਨੂੰ ਨਿਰੋਗ ਰੱਖਦੇ ਹਾਂ ਲਾਸਟ ਵਿੱਚ ਮੇਰਾ ਇਹੀ ਹੈ ਵੀ ਜਿੰਨੇ ਵੀ ਮੇਰੇ ਛੋਟੇ ਅਤੇ ਵੱਡੇ ਭਰਾ ਜਿੰਨੇ ਵੀ ਹਨ ਜਿੰਨੇ ਮਤਲਬ ਖ਼ਾਸਕਰ ਬੱਚੇ ਅਤੇ ਬੱਚੀਆਂ ਸਾਰਿਆਂ ਨੂੰ ਗੇਮ ਕਿਸੇ ਕਿਸਮ ਦੀ ਵੀ ਖ਼ਾਸਕਰ ਕਬੱਡੀ ਬਾਰੇ ਮੈਂ ਕਹਿਣਾ ਚਾਹੁੰਦਾ ਕਬੱਡੀ ਮੈਂ ਖੇਡਦਾ ਰਿਹਾ ਛੋਟਾ ਹੁੰਦਾ ਤੇ ਮੈਂ ਅੱਜ ਵੀ ਕਬੱਡੀ ਚ ਹੀ ਇੰਟਰਸਟਿਡ ਆ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਵੀ ਬੱਚਿਆਂ ਨੂੰ ਤੇ ਬੱਚੀਆਂ ਨੂੰ ਕਬੱਡੀ ਨਾਲ਼ ਮਤਲਬ ਪਿਆਰ ਹੋਣਾ ਚਾਹੀਦਾ ਕਬੱਡੀ ਖੇਡਣੀ ਚਾਹੀਦੀ ਹੈ ਚੰਗੀ ਖ਼ੁਰਾਕ ਦੁੱਧ ਮੱਖਣ ਜਿਵੇਂ ਕਿ ਫਾਸਟ ਫੂਡ ਹੈ ਇਸ ਤੋਂ ਬਚਣਾ ਚਾਹੀਦਾ ਹੈ ਦੇਸੀ ਘੀ ਤਾਕਤ ਲਈ ਕਬੱਡੀ ਖੇਡਣ ਲਈ ਵਧੀਆ ਜ਼ੋਰ ਅਜ਼ਮਾਇਸ਼ ਮਤਲਬ ਕਰਨ ਲਈ ਚੰਗਾ ਪੰਜਾਬ ਦਾ ਦੁੱਧ ਦੇਸੀ ਘਿਓ ਖਾਣਾ ਚਾਹੀਦਾ ਲਾਸਟ ਤੇ ਮੈਂ ਫੇਰ ਮਤਲਬ ਬੱਚੇ ਬੱਚੀਆਂ ਨੂੰ ਤੇ ਸਾਰਿਆਂ ਨੂੰ ਮਤਲਬ ਮੈਂ ਇਹ ਕਹਿਣਾ ਚਾਹੁੰਦਾ ਵੀ ਸਾਡੇ ਮਤਲਬ ਪੰਜਾਬ ਵਿੱਚ ਸਾਡੇ ਔਲ ਇੰਡੀਆ ਵਿੱਚ ਸਾਡੇ ਬਜ਼ੁਰਗ ਵੀ ਕਬੱਡੀ ਖੇਡਦੇ ਹਨ ਬੱਚਿਆਂ ਤੇ ਬੱਚੀਆਂ ਨੂੰ ਤਾਂ ਖੇਡਣਾ ਹੀ ਚਾਹੀਦਾ ਇਸ ਕਰਕੇ ਲਾਸਟ ਤੇ ਮੈਂ ਇਹੀ ਕਹਿਣਾ ਚਾਹੁੰਦਾ ਮੈਂ ਲਾਸਟ ਤੇ ਧੰਨਵਾਦ ਕਰਨਾ ਚਾਹੁੰਦਾ ਵੀ ਇਹ ਗੇਮ ਬਹੁਤ ਵਧੀਆ ਧੰਨਵਾਦ ਸਰ